ਸੰਸਾਰ ਵਿੱਚ ਬਹੁਤ ਸਾਰੇ ਲੇਖਕ ਹਨ ਅਤੇ ਹਰੇਕ ਲੇਖਕ ਆਪਣੀ ਸੋਚ ਆਪਣੇ ਵਿਚਾਰਾਂ ਅਤੇ ਆਪਣੇ ਅਨੁਭਵਾਂ ਦੇ ਅਨੁਸਾਰ ਲਿਖਤਾਂ ਲਿਖਦੇ ਹਨ ਅਤੇ ਜ਼ਰੂਰੀ ਨਹੀਂ ਕਿ ਸਾਰੇ ਲੇਖਕ ਦੀਆਂ ਲਿਖਤਾਂ ਨੂੰ ਚੰਗੀ ਫੀਡਬੈਕ ਮਿਲੇ ਹਰ ਇੱਕ ਇਨਸਾਨ ਦੇ ਆਪਣੇ ਆਪਣੇ ਵੱਖਰੇ ਵਿਚਾਰ ਹੁੰਦੇ ਹਨ ਅਤੇ ਹਾਂ ਬਹੁਤ ਵਾਰ ਮਹਿਸੂਸ ਕੀਤਾ ਹੈ ਕਿ ਸਾਡੀ ਲਿਖਤ ਕਾਫੀ ਚੰਗੀ ਨਹੀਂ ਕਿਉਂਕਿ ਜੇਕਰ ਉਸਨੂੰ ਵੇਖਣ ਵਾਲੇ ਸੌ ਲੋਕ ਹਨ ਤਾਂ ਉਹਨਾਂ ਵਿੱਚੋਂ ਪੰਦਰਾਂ ਜਾਂ ਵੀਹ ਦੇ ਹੀ ਵਧੀਆ ਫੀਡਬੈਕ ਆਉਂਦੇ ਹਨ ਬਾਕੀ ਸਿਰਫ ਦੇਖ ਕੇ ਛੱਡ ਦਿੰਦੇ ਹਨ ਤਾਂ ਜਿਸ ਨਾਲ ਮਹਿਸੂਸ ਹੁੰਦਾ ਹੈ ਕਿ ਸਾਡੀ ਲਿਖਤ ਕਾਫੀ ਚੰਗੀ ਨਹੀਂ ਹੈ ਪਰ ਦੂਜੇ ਪਾਸੇ ਇਹ ਵੀ ਹੈ ਕਿ ਹਰ ਇੱਕ ਇਨਸਾਨ ਦੇ ਵਿਚਾਰ ਵੱਖਰੇ ਹਨ ਤਾਂ ਉਹਨਾਂ ਦਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੀ ਵੱਖਰਾ ਹੁੰਦਾ ਹੈ ਹਾਂ ਸਾਨੂੰ ਫੀਡਬੈਕ ਮਿਲੀ ਹੈ ਜਿਸਨੇ ਬਹੁਤ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਇੱਦਾਂ ਹੀ ਲਿਖਦੇ ਰਹੋ